ਪੰਜਾਬ ਦੇ ਸੱਭਿਆਚਾਰ ਵਿੱਚ ਬਹੁਤ ਸਾਰੇ ਧਰਮ ਦੇ ਲੋਕ ਰਹਿੰਦੇ ਹਨ ਜਿਵੇਂ ਕਿ ਮੁਸਲਮਾਨ ਹੋ ਗਏ ਸਿੱਖ ਭਾਈਚਾਰਾ ਹੋ ਗਿਆ ਅਤੇ ਹਿੰਦੂ ਧਰਮ ਦੇ ਲੋਕ ਵੀ ਰਹਿੰਦੇ ਹੈ ਅਲੱਗ ਧਰਮ ਦੇ ਬਹੁਤ ਸਾਰੇ ਲੋਕ ਰਹਿੰਦੇ ਹੈ ਜਿਹੜੇ ਕਿ ਆਪਣੇ ਆਪਣੇ ਗੁਰੂਆਂ ਦੀ ਸਾਧਨਾ ਕਰਦੇ ਹੈ ਜਿੱਦਾਂ ਕਿ ਸਿੱਖ ਧਰਮ ਵਿੱਚ ਦਸਾਂ ਗੁਰੂਆਂ ਦੀ ਸਾਧਨਾ ਕੀਤੀ ਜਾਂਦੀ ਹੈ ਅਤੇ ਹਿੰਦੂ ਧਰਮ ਵਾਲੇ ਲੋਕ ਹੈ ਜੋ ਉਹ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹੈ ਅਤੇ ਮੁਸਲਮਾਨ ਭਾਈਚਾਰੇ ਵਿੱਚ ਕੁਰਾਨ ਪੜ੍ਹਿਆ ਜਾਂਦਾ ਹੈ ਅਤੇ ਉਹ ਆਪਣੇ ਆਪਣੀ ਗੁਰੂਆਂ ਪੀਰਾਂ ਦੀ ਸਾਧਨਾ ਕਰਦੇ ਹੈ ਅਤੇ ਜਿਹੜੇ ਇਸ ਤੋਂ ਬਾਵਜੂਦ ਵੀ ਲੋਕ ਹੈ ਜੋ ਇੱਕ ਦੂਜੇ ਦੇ ਧਰਮ ਦੀ ਬਿਲਕੁਲ ਪੂਰਾ ਸਤਿਕਾਰ ਕਰਦੇ ਹੈ ਅਤੇ ਇੱਕ ਦੂਜੇ ਧਰਮ ਦਾ ਆਦਰ ਕਰਦੇ